ਪੰਜਾਬ ਮੁੰਬਈ ਗੁਜਰਾਤ ਮੱਧ ਪ੍ਰਦੇਸ਼ ਜੰਮੂ ਕਸ਼ਮੀਰ ਹਰਿਆਣਾ ਚੰਡੀਗੜ੍ਹ ਬਠਿੰਡਾ ਹਿਮਾਚਲ ਪ੍ਰਦੇਸ਼ ਲੰਡਨ ਕਨੇਡਾ ਇੰਗਲੈਂਡ ਅਮਰੀਕਾ ਰੂਸ ਨਿਊਜ਼ੀਲੈਂਡ ਆਸਟਰੇਲੀਆ ਜਪਾਨ ਜਰਮਨੀ ਸਾਊਥ ਕੋਰੀਆ ਅਫਰੀਕਾ ਦਕਸ਼ਿਨ ਅਫਰੀਕਾ